ਪਰਸੋਂ ਮੈਂ ਆਪਣੇ ਪੰਜ ਸੱਤ ਦੋਸਤਾਂ ਨੂੰ ਫੋਨ ਕੀਤਾ ਅਤੇ ਉਹਨਾਂ ਨੂੰ ਇੱਕ ਥਾਂ ਇਕੱਠੇ ਕੀਤਾ ਅਤੇ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕੀਤੀ ਕਿ ਆਪਾਂ ਕਿਤੇ ਬਾਹਰ ਘੁੰਮਣ ਚਲਦੇ ਹਾਂ ਅਤੇ ਸਾਡਾ ਮਨੀਕਰਨ ਸਾਹਿਬ ਦਾ ਅਸੀਂ ਪਲੈਨ ਬਣਾਇਆ ਕਿ ਅਸੀਂ ਛੇ ਤਰੀਕ ਨੂੰ ਮਨੀਕਰਨ ਸਾਹਿਬ ਚਲਦੇ ਹਾਂ ਅਤੇ ਅਸੀਂ ਪਹਿਲਾਂ ਆਪਣੇ ਜ਼ਰੂਰੀ ਕੰਮ ਨਿਪਟਾਏ ਕਿ ਜਦੋਂ ਅਸੀਂ ਆਰਾਮ ਨਾਲ ਜਾਈਏ ਅਤੇ ਆਰਾਮ ਨਾਲ ਹੀ ਵਾਪਸ ਆਈਏ ਤਾਂ ਪਹਿਲਾਂ ਅਸੀਂ ਆਪਣੇ ਸਾਰੇ ਕੰਮ ਨਿਬੇੜ ਕੇ ਜ਼ਰੂਰੀ ਕੰਮ ਕਾਜ ਅਤੇ ਫਿਰ ਅਸੀਂ ਛੇ ਤਰੀਕ ਨੂੰ ਸਵੇਰੇ ਨਿਕਲੇ ਛੇ ਵਜੇ ਅਤੇ ਅਸੀਂ ਪਹਿਲਾਂ ਇੱਥੋਂ ਤੁਰੇ ਅਤੇ ਅਸੀਂ ਪਹਿਲਾਂ ਕੀਰਤਪੁਰ ਸਾਹਿਬ ਰੁਕੇ ਅਤੇ ਉੱਥੇ ਅਸੀਂ ਜਾ ਕੇ ਚਾਹ ਪੀਤੀ ਅਤੇ ਨਾਸ਼ਤਾ ਕੀਤਾ ਅਤੇ ਉਸ ਤੋਂ ਬਾਅਦ ਅਸੀਂ ਜਾ ਕੇ ਬਿਲਾਸਪੁਰ ਰੁਕੇ ਅਤੇ ਐਵੇਂ ਕਰਕੇ ਅਸੀਂ ਅਤੇ ਮਨੀਕਰਨ ਸਾਹਿਬ ਵਿਖੇ ਜਾ ਕੇ ਅਸੀਂ ਮੱਥਾ ਟੇਕਿਆ ਅਤੇ ਉੱਥੇ ਦਰਸ਼ਨ ਬਾਬਾ ਜੀ ਦੇ ਦਰਸ਼ਨ ਕੀਤੇ ਅਤੇ ਸਾਨੂੰ ਉੱਥੇ ਜਾ ਕੇ ਬਹੁਤ ਚੰਗਾ ਲੱਗਿਆ ਅਤੇ ਜਿਹੜੇ ਮੇਰੇ ਨਾਲ ਦੇ ਸੀ ਉਹਨਾਂ ਨੂੰ ਵੀ ਬਹੁਤ ਚੰਗਾ ਲੱਗਿਆ ਕਿਉਂਕਿ ਉਹ ਬਹੁਤ ਖੁਸ਼ ਸੀ ਕੀ ਅਸੀਂ ਦਰਸ਼ਨ ਕੀਤੇ ਹਨ ਅਤੇ ਅਸੀਂ ਬਾਈਕਿੰਗ ਕਰਦੇ ਹੋਏ ਵੀ ਅਸੀਂ ਬਹੁਤ ਇੰਜੋਏ ਕੀਤਾ ਅਤੇ ਬਹੁਤ ਫਨ ਕੀਤਾ ਅਤੇ ਸਾਨੂੰ ਸਾਰਿਆਂ ਨੂੰ ਬਹੁਤ ਚੰਗਾ ਲੱਗਿਆ ਅਤੇ ਅਸੀਂ ਸਾਰੇ ਟੈਨਸ਼ਨ ਫਰੀ ਗਏ ਅਤੇ ਟੈਂਸ਼ਨ ਫਰੀ ਆਏ ਘਰ ਅਤੇ ਸਾਨੂੰ ਇਹ ਬਾਈਕਿੰਗ ਕਰਕੇ ਬਹੁਤ ਚੰਗਾ ਲੱਗਿਆ